ਹਾਂਜੀ ਵਿਗਿਆਨ ਅਤੇ ਟੈਕਨੋਲੋਜੀ ਸਾਡੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਗਿਆ ਹੈ ਵਿਗਿਆਨ ਨੇ ਬਹੁਤ ਸਾਰੀਆਂ ਕਾਢਾਂ ਕੱਢ ਕੇ ਸਾਨੂੰ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਿੱਤਾ ਹੈ ਜਿਵੇਂ ਕੁਝ ਮਹੀਨੇ ਪਹਿਲਾਂ ਹੀ ਚੰਦਰਯਾਨ ਨੂੰ ਆਕਾਸ਼ ਵਿੱਚ ਛੱਡਿਆ ਗਿਆ ਇਹ ਛੱਡਿਆ ਗਿਆ ਹੈ ਇਹ ਚੰਦਰਯਾਨ ਚੰਦਰਮਾ 'ਤੇ ਜਾ ਕੇ ਉੱਥੇ ਪਾਣੀ ਦੀ ਖੋਜ ਕਰਦਾ ਹੈ ਅਤੇ ਜੀਵਨ ਹੋਣ ਦਾ ਸੰਭਾਵਨਾ ਸੰਭਾਵਨਾ ਹੈ ਉਸ ਬਾਰੇ ਖੋਜ ਕੀਤੀ ਜਾ ਰਹੀ ਹੈ ਇਹ ਯਾਨ ਸਾਨੂੰ ਉੱਥੋਂ ਦੀਆਂ ਤਸਵੀਰਾਂ ਭੇਜਦਾ ਹੈ ਜੋ ਅਸੀਂ ਦੇਖ ਨਹੀਂ ਸਕਦੇ ਹਾਂ ਸੈੱਟਲਾਈਟ ਜੋ ਸਾਡੇ ਪ੍ਰਿਥਵੀ ਤੋਂ ਇਲਾਵਾ ਹੋਰ ਬ੍ਰਹਿਮੰਡ ਦੀਆਂ ਤਸਵੀਰਾਂ ਭੇਜਦਾ ਹੈ ਅਤੇ ਦੁਨੀਆ ਦੇ ਹਰ ਖੇਤਰਾਂ ਦੀ ਜਾਣਕਾਰੀ ਦਿੰਦਾ ਹੈ ਜਿਵੇਂ ਕੁਝ ਮਹੀਨਾ ਕੁਝ ਮਸ਼ੀਨਾਂ ਸਮਾਰਟਫੋਨ ਅਤੇ ਮਨੋਰੰਜਨ ਦੇ ਮਨੋਰੰਜਨ ਦੇ ਸਾਧਨ ਤਿਆਰ ਕੀਤੇ ਗਏ ਹਨ ਇਹ ਨਵੀਨਤਾ ਸਾਡੀ ਜ਼ਿੰਦਗੀ ਲਈ ਬਹੁਤ ਸਾਰੀਆਂ ਚੀਜ਼ਾਂ ਬਣ ਕੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿ ਦਿੱਤਾ ਹੈ